ਹਾਂਜੀ ਸਰ ਮੈਨੂੰ ਕੰਮ ਕਰਦੇ ਨੂੰ ਤਕਰੀਬਨ ਅੱਠ ਸਾਲ ਹੋ ਗਏ ਹੈ ਅਤੇ ਮੈਂ ਇਹ ਕੰਮ ਆਪਣੇ ਮੇਰੇ ਚਾਚਾ ਜੀ ਕਰਦੇ ਸੀ ਉਹਨਾਂ ਤੋ ਸਿੱਖਿਆ ਸੀ